ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਇਸ ਲਈ ਮੈਂ ਸੋਚਿਆ ਕਿ ਮੈਂ ਬਾਜ਼ਾਰ ਜਾ ਕੇ ਕੁਛ ਕੱਪੜੇ ਲੈ ਕੇ ਆਵਾਂ ਫਿਰ ਮੈਂ ਬਾਜ਼ਾਰ ਗਈ ਅਤੇ ਮੈਂ ਦੇਖਿਆ ਕਿ ਉੱਥੇ ਮੈਨੂੰ ਕੋਈ ਵੀ ਕੱਪੜੇ ਪਸੰਦ ਨਹੀਂ ਆ ਰਹੇ ਫਿਰ ਮੈਂ ਔਨਲਾਈਨ ਕੱਪੜੇ ਖਰੀਦਣ ਬਾਰੇ ਸੋਚਿਆ ਅਤੇ ਫਿਰ ਮੈਂ ਔਨਲਾਈਨ ਦੋ ਦੋ ਕੁੜਤੀਆਂ ਮੰਗਵਾਈਆਂ ਉਹਨਾਂ ਦਾ ਕੱਪੜਾ ਬਹੁਤ ਜ਼ਿਆਦਾ ਅੱਛਾ ਸੀ ਉਹਨਾਂ ਦੇ ਡਿਜ਼ਾਇਨ ਬਹੁਤ ਜ਼ਿਆਦਾ ਸੁੰਦਰ ਸੀ ਉਹਨਾਂ 'ਤੇ ਜੋ ਵੀ ਕਢਾਈ ਕੱਢੀ ਹੋਈ ਸੀ ਉਹ ਵੀ ਬਹੁਤ ਜ਼ਿਆਦਾ ਵਧੀਆ ਸੀ ਇਹ ਮੈਨੂੰ ਬਹੁਤ ਹੀ ਸਸਤੇ ਰੇਟ ਦੇ ਵਿੱਚ ਕੁੜਤੀਆਂ ਮਿਲ ਗਈਆਂ ਇਹਨਾਂ ਦਾ ਕਲਰ ਹੀ ਬਹੁਤ ਹੀ ਜ਼ਿਆਦਾ ਸੁੰਦਰ ਸੀ ਇਹਨਾਂ ਦੀ ਫਿਟਿੰਗ ਬਹੁਤ ਹੀ ਜ਼ਿਆਦਾ ਵਧੀਆ ਸੀ ਮੇਰਾ ਓਵਰਔਲ ਐਕਸਪੀਰੀਐਂਸ ਕੁੜਤੀਆਂ ਨੂੰ ਲੈ ਕੇ ਬਹੁਤ ਵਧੀਆ ਰਿਹਾ ਮਤਲਬ ਮੇਰੀ ਇਹ ਸ਼ੋਪਿੰਗ ਕਰਕੇ ਬਹੁਤ ਜ਼ਿਆਦਾ ਸੰਤੁਸ਼ਟੀ ਹੋਈ ਇਹ ਜੋ ਵੀ ਮੈਂ ਕੁੜਤੀਆਂ ਮੰਗਵਾਈਆਂ ਇਹਨਾਂ ਦਾ ਕਾ ਕੱਪੜਾ ਬਹੁਤ ਜ਼ਿਆਦਾ ਵਧੀਆ ਸੀ ਡਿਜ਼ਾਇਨ ਵੀ ਬਹੁਤ ਜ਼ਿਆਦਾ ਅੱਛਾ ਸੀ ਇਹਨਾਂ ਦੇ ਬ ਪ੍ਰਾਈਜ਼ ਜੋ ਹੈ ਉਹ ਵੀ ਬਹੁਤ ਜ਼ਿਆਦਾ ਵਧੀਆ ਸੀ ਕਲਰ ਵੀ ਇਹਨਾਂ ਦਾ ਬਿਲਕੁਲ ਸਹੀ ਸੀ ਅਤੇ ਇਹਨਾਂ ਦੀ ਫਿਟਿੰਗ ਵਗੈਰਾ ਵੀ ਬਿਲਕੁਲ ਸਹੀ ਸੀ ਸਾਈਜ਼ ਵੀ ਬਿਲਕੁਲ ਸਹੀ ਸੀ ਅਤੇ ਇਸ ਤਰੀਕੇ ਨਾਲ ਮੇਰਾ ਓਵਰਔਲ ਐਕਸਪੀਰੀਐਂਸ ਜੋ ਹੈ ਇਹਨਾਂ ਕੁੜਤੀਆਂ ਨੂੰ ਲੈ ਕੇ ਬਹੁਤ ਵਧੀਆ ਰਿਹਾ ਅਤੇ ਮੈਨੂੰ ਕੋਈ ਵੀ ਅਸੰਤੁਸ਼ਟੀ ਜਾਂ ਕੋਈ ਵੀ ਪ੍ਰੋਬਲਮ ਨਹੀਂ ਆਈ ਇਹਨਾਂ ਕੱਪੜਿਆਂ ਨੂੰ ਲੈਣ ਦੇ ਵਿੱਚ ਅਤੇ ਇਸ ਲਈ ਮੈਂ ਸੋਚਿਆ ਕਿ ਅੱਗੇ ਤੋਂ ਵੀ ਫਰਦਰ ਮੈਂ ਇੱਦਾਂ ਹੀ ਔਨਲਾਈਨ ਸ਼ਾਪਿੰਗ ਕਰਨੀ